ਹਾਂ ਸੰਧਾਈ ਦਾ ਹਫਤਾਵਾਰੀ ਆਯੋਜਨ ਸਾਡੇ ਪਿੰਡ ਵਿੱਚ ਬਾਹਰ ਇੱਕ ਖੁੱਲ੍ਹੀ ਗਰਾਉਂਡ ਦੇ ਵਿੱਚ ਕੀਤਾ ਜਾਂਦਾ ਹੈ ਗਰਾਉਂਡ ਕਾਫੀ ਖੁੱਲ੍ਹੀ ਹੋਣ ਦਾ ਕਰਕੇ ਅਤੇ ਇੱਕ ਕਾਰਨ ਮੇਨ ਰੋਡ ਦੇ ਉੱਤੇ ਪਿੰਡ ਦਾ ਹੋਣ ਦਾ ਕਰਕੇ ਲਾਗੇ ਬੰਨੇ ਦੇ ਪੰਦਰ੍ਹਾਂ ਵੀਹ ਪਿੰਡ ਇੱਥੋਂ ਦੀ ਸਫਰ ਕਰਦੇ ਆ ਲੰਘਦੇ ਆ ਅਤੇ ਆਪਣੇ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਵਾ ਉਹ ਇੱਥੋਂ ਲੈ ਕੇ ਜਾਂਦੇ ਆ ਵੱਖ ਵੱਖ ਖਿੱਤਿਆਂ ਦੇ ਲੋਕ ਆਪੋ ਆਪਣੀਆਂ ਚੀਜ਼ਾਂ ਬਣਾ ਕੇ ਇੱਥੇ ਵੇਚਣ ਵਾਸਤੇ ਆਉਂਦੇ ਹਨ ਜਿਸ ਤਰ੍ਹਾਂ ਕੁਝ ਲੱਕੜ ਦਾ ਕੰਮ ਕਰਨ ਵਾਲੇ ਲੱਕੜ ਦੀਆਂ ਚੀਜ਼ਾਂ ਲਿਆ ਕੇ ਵੇਚਦੇ ਹਨ ਕੁਝ ਲੋਹੇ ਦਾ ਕੰਮ ਕਰਨ ਵਾਲੇ ਲੋਹੇ ਦੀਆਂ ਚੀਜ਼ਾਂ ਲਿਆ ਕੇ ਵੇਚਦੇ ਹਨ ਜਿਹਨਾਂ ਵਿੱਚ ਕੁਝ ਖੇਤੀਬਾੜੀ ਦੇ ਸੰਦ ਵੀ ਹੁੰਦੇ ਹਨ ਕੁਝ ਕਿਸਾਨ ਜਿਹਨਾਂ ਨੇ ਮੱਖੀਆਂ ਪਾਲੀਆਂ ਹੋਈਆਂ ਨੇ ਉਹ ਸ਼ੁੱਧ ਸ਼ਹਿਦ ਲਿਆ ਕੇ ਡੱਬਿਆਂ ਦੇ ਵਿੱਚ ਪਾ ਕੇ ਇੱਥੇ ਵੇਚ ਕੇ ਜਾਂਦੇ ਹਨ ਅਤੇ ਕੁਝ ਚੀਜ਼ਾਂ ਦੇ ਵਿੱਚ ਮਿਲਾਵਟ ਹੋਣ ਦਾ ਕਰਕੇ ਲੋਕ ਕੁਝ ਔਰਗੈਨਿਕ ਚੀਜ਼ਾਂ ਨੂੰ ਪਹਿਲ ਦਿੰਦੇ ਹਨ ਅਤੇ ਸਾਡੇ ਇੱਥੋਂ ਦੀ ਹਲਦੀ ਕਾਫੀ ਮਸ਼ਹੂਰ ਮੰਨੀ ਜਾਂਦੀ ਹੈ ਜਿਹੜੀ ਔਰਗੈਨਿਕ ਹੁੰਦੀ ਹੈ ਉਹ ਹਲਦੀ ਵੀ ਇੱਥੋਂ ਦੇ ਲੋਕ ਲੈ ਕੇ ਜਾਂਦੇ ਹਨ